ਸਾਡੇ ਖਿਆਲ ਵਿੱਚ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸੇ ਵੀ ਦਫਤਰ ਵਿੱਚ ਕੰਮ ਪੰਜਾਬੀ ਵਿੱਚ ਨਹੀਂ ਹੁੰਦਾ ਅਤੇ ਪੰਜਾਬ ਦੇ ਸਾਰੇ ਹੀ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਾ ਪੰਜਾਬੀ ਪੜ੍ਹਾਈ ਨਹੀਂ ਜਾਂਦੀ ਅਤੇ ਬੋਰਡ ਵੀ ਅੰਗਰੇਜ਼ੀ ਭਾਸ਼ਾ ਵਿੱਚ ਲਿਖੇ ਜਾਂਦੇ ਹਨ ਅਤੇ ਕੇਂਦਰ ਤੋਂ ਅਫਸਰ ਪੰਜਾਬ ਆ ਕੇ ਹਿੰਦੀ ਦੇ ਵਿੱਚ ਹੀ ਬੋਲਦੇ ਹਨ ਅਤੇ ਜੋ ਕੰਮ ਸੰਬੰਧੀ ਦਫਤਰਾਂ ਦੀਆਂ ਚਿੱਠੀਆਂ ਨਿਕਲਦੀਆਂ ਹਨ ਉਹ ਵੀ ਹਿੰਦੀ ਭਾਸ਼ਾ ਦੇ ਵਿੱਚ ਕੱਢੀਆਂ ਜਾਂਦੀਆਂ ਹਨ ਅਤੇ ਜੋ ਵੀ ਸਾਡੇ ਦਫਤਰਾਂ ਦੇ ਵਿੱਚ ਬੋਲਚਾਲ ਹੁੰਦੀ ਹੈ ਉਹ ਵੀ ਸਾਰੇ ਹੀ ਇੰਗਲਿਸ਼ ਦੇ ਵਿੱਚ ਬੋਲਦੇ ਹਨ ਇਸ ਲਈ ਸਾਨੂੰ ਸਾਡੀ ਪੰਜਾਬੀ ਭਾਸ਼ਾ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਪੈ ਰਿਹਾ ਹੈ